ਹੈਲੋ ਗੁਡ ਆਫਟਰਨੂਨ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਤਾਂ ਉਹਨਾਂ ਨੇ ਆਪਕੋ ਮੈਡੀਸਨ ਵਗੈਰਾ ਦਿੱਤੀ ਹੈ ਜਾਂ ਕੁਛ ਹਾਂਜੀ ਕਿੰਨੇ ਦਿਨਾਂ ਲਈ ਦਿੱਤੀ ਉਹਨਾਂ ਨੇ ਮੈਡੀਸਨ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਦੇਖੋ ਸ਼ੂਗਰ ਦਾ ਤਾਂ ਦੇਖੋ ਹੁੰਦਾ ਹੈ ਥੋੜ੍ਹਾ ਜਿਹਾ ਇਹਦੇ ਲਈ ਥੋੜ੍ਹਾ ਜਿਹਾ ਪਰਹੇਜ਼ ਵੀ ਜ਼ਰੂਰੀ ਹੈ ਦੇਖੋ ਜਿਹੜੀ ਤੁਸੀਂ ਮੈਡੀਸਿਨਸ ਵਗੈਰਾ ਲੈ ਰਹੇ ਹੋ ਕੁਛ ਵੀ ਹੈ ਨਾ ਕਰ ਰਹੇ ਹੋ ਤਾਂ ਉਹ ਤਾਂ ਤੁਸੀਂ ਰੈਗੂਲਰ ਲਓ ਹੀ ਲਓ ਔਰ ਤੁਸੀਂ ਆਪਣੀ ਡਾਇਟ ਤਾਂ ਵੀ ਕੰਟਰੋਲ 'ਚ ਰੱਖੋ ਅਗਰ ਤਾਂ ਪ੍ਰੋਪਰ ਡਾਇਟ ਲਓ ਤੁਸੀਂ ਹਾਂਜੀ ਸਭ ਤੋਂ ਫਸਟ ਆਫ ਆਲ ਤਾਂ ਤੁਹਾਨੂੰ ਮਿੱਠਾ ਛੱਡਣਾ ਪਏਗਾ ਇੱਕ ਵਾਰ ਹਾਂਜੀ ਚਾਹ ਵਗੈਰਾ ਘੱਟ ਕਰ ਦਿਓ ਅਗਰ ਲੈਂਦੇ ਹੋ ਤਾਂ ਫਿੱਕੀ ਚਾਏ ਲਓ ਹਲਕਾ ਫੁਲਕਾ ਥੋੜ੍ਹਾ ਮਿੱਠਾ ਪਾ ਸਕਦੇ ਹੋ ਪਰ ਥੋੜ੍ਹਾ ਜਿਹਾ ਘੱਟ ਹੀ ਰੱਖੋ ਮਿੱਠਾ ਵਗੈਰਾ ਤਾਂ ਹੀ ਕੰਟਰੋਲ 'ਚ ਹੋ ਸਕਦੀ ਹੈ ਅਗਰ ਹੁਣੇ ਕੰਟਰੋਲ ਕਰੋਗੇ ਤਾਂ ਬਾਅਦ ਦੇ ਵਿੱਚ ਤੁਹਾਨੂੰ ਦਿੱਕਤ ਨਹੀਂ ਆਏਗੀ ਹਾਂਜੀ ਅਤੇ ਉਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਹੋਮ ਰੈਮਡੀਜ ਵਗੈਰਾ ਵੀ ਯੂਜ ਕਰੋ ਅੱਜ ਕੱਲ੍ਹ ਵੈਸੇ ਵੀ ਯੂਟੀਊਬ ਵਗੈਰਾ 'ਤੇ ਜਾਂ ਹੈ ਨਾ ਇਹਨਾਂ ਚੀਜ਼ਾਂ 'ਤੇ ਬਥੇਰੇ ਨੁਸਖੇ ਵਗੈਰਾ ਹੁੰਦੇ ਆ ਦਸ ਦਿੰਦੇ ਆ ਹਾਂਜੀ ਬਾਕੀ ਅਗਰ ਜੋ ਕੁਛ ਵੀ ਹੋਇਆ ਮਤਲਬ ਹੈ ਨਾ ਮੈਂ ਤੁਹਾਨੂੰ ਡਾਇਟ ਵਗੈਰਾ ਭੇਜ ਦਵਾਂਗੀ ਸਾਰਾ ਸ਼ੈਡਿਊਲ ਪੇਜ ਦਵਾਂਗੇ ਅਤੇ ਤੁਸੀਂ ਉਹ ਫੋਲੋ ਕਰਨਾ ਹੈ ਪ੍ਰੋਪਰ ਫੋਲੋ ਕਰਨਾ ਅਗਰ ਫੋਲੋ ਕਰੋਗੇ ਤਾਂ ਕੰਟਰੋਲ ਹੋਏਗਾ ਅਦਰਵਾਈਜ਼ ਕੁਛ ਨਹੀਂ ਹੋਏਗਾ ਹਾਂਜੀ ਬਸ ਤੁਸੀਂ ਇੱਕ ਵਾਰ ਮੈਡੀਸਨ ਲਓ ਅਤੇ ਮੈਂ ਤੁਹਾਨੂੰ ਆਪਣਾ ਸਾਰਾ ਹੈ ਨਾ ਡਾਈਟ ਚਾਰਟ ਭੇਜ ਦਿੰਦੀ ਹਾਂ ਅਤੇ ਸ਼ੈਡਿਊਲ ਭੇਜ ਦਿੰਦੀ ਹਾਂ ਕਿਸ ਤਰ੍ਹਾਂ ਤੁਸੀਂ ਹੈ ਨਾ ਮੈਂ ਮੈਡੀਸਨ ਵਗੈਰਾ ਲੈਣੀ ਹੈ ਅਤੇ ਆਪਣੀ ਡਾਇਟ ਕਿਵੇਂ ਸੈੱਟ ਕਰਨੀ ਹੈ ਹਾਂਜੀ ਅਤੇ ਉਹ ਤੁਸੀਂ ਪ੍ਰੋਪਰ ਡਾਇਟ ਫੋਲੋ ਕਰਨੀ ਹੈ ਤੁਸੀਂ ਤੁਹਾਨੂੰ ਇੱਕ ਹਫਤੇ ਦੇ ਵਿੱਚ ਵਿੱਚ ਜਾਂ ਟੇਨ ਡੇਸ ਦੇ ਵਿੱਚ ਵਿੱਚ ਤੁਹਾਨੂੰ ਫਰਕ ਦਿਖ ਜਾਏਗਾ ਹਾਂਜੀ ਹਾਂਜੀ ਤਾਂ ਫਿਰ ਰਿਵਿਊ ਤਾਂ ਦੇਖੋ ਫਿਰ ਤਾਂ ਲੈਣਾ ਬਣਦਾ ਅਗਰ ਤੁਸੀਂ ਸੈੱਟ ਹੋਗੇ ਤਾਂ ਅੱਛੀ ਗੱਲ ਹੈ ਕਿਉਂਕਿ ਇਹ ਇਹਦੇ ਲਈ ਤਾਂ ਪ੍ਰੋਪਰ ਤੁਹਾਨੂੰ ਕੇਅਰ ਕਰਨੀ ਹੀ ਪਏਗੀ ਮਿੱਠਾ ਸਭ ਤੋਂ ਪਹਿਲਾਂ ਛੱਡਣਾ ਹੀ ਪੈਣਾ ਤੁਹਾਨੂੰ ਅਤੇ ਮਿੱਠਾ ਨਹੀਂ ਲੈਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਵੈਲਕਮ ਜੀ ਓਕੇ ਹੈ